ਮੈਨੂੰ ਨਿਮੰਤਰ ਖੇਡਾਂ ਅਤੇ ਸਮਾਗਮਾਂ ਦੀ ਜਾਣਕਾਰੀ ਸੋਸ਼ਲ ਮੀਡੀਆ ਅਖਬਾਰਾਂ ਦੁਆਰਾ ਪਤਾ ਲੱਗਦੀ ਰਹਿੰਦੀ ਹੈ ਮੈਂ ਇੰਸਟਾਗ੍ਰਾਮ 'ਤੇ ਕਈ ਸਪੋਰਟਸ ਪੇਜ ਅਤੇ ਕਈ ਖਿਡਾਰੀਆਂ ਨੂੰ ਫੋਲੋ ਕਰਦਾ ਹਾਂ ਅਖ਼ਬਾਰਾਂ ਤੋਂ ਵੀ ਮੈਨੂੰ ਆਉਣ ਵਾਲੀਆਂ ਖੇਡਾਂ ਅਤੇ ਸਮਾਗਮਾਂ ਦੀ ਜਾਣਕਾਰੀ ਮਿਲਦੀ ਹੈ ਇਸ ਤੋਂ ਇਲਾਵਾ ਨਿਊਜ ਚੈਨਲਾਂ ਅਤੇ ਆਉਣ ਵਾਲੇ ਸਪੋਰਟ ਪ੍ਰੋਗ ਬੋਡਕਾਸਟ ਵੀ ਮੈਂ ਦੇਖਦਾ ਰਹਿੰਦਾ ਹਾਂ ਜੋ ਕਿ ਮੇਰੀ ਜਾਣਕਾਰੀ ਵਿੱਚ ਬਹੁਤ ਹੀ ਵਾਧਾ ਕਰਦੇ ਹਨ ਮੇਰੀ ਮਨਪਸੰਦ ਖੇਡ ਕ੍ਰਿਕਟ ਹੈ ਅਤੇ ਮੈਨੂੰ ਦੇਖਣੀ ਵੀ ਬਹੁਤ ਵਧੀਆ ਲੱਗਦੀ ਹੈ ਇਸ ਵਿੱਚ ਮੇਰਾ ਮਨ ਪਸੰਦੀਦਾ ਖਿਡਾਰੀ ਐੱਮ ਐੱਸ ਧੋਨੀ ਹੈ ਜੋ ਮੈਨੂੰ ਕ੍ਰਿਕਟ ਖੇਡਣੀ ਵੀ ਬਹੁਤ ਵਧੀਆ ਲੱਗਦੀ ਹੈ ਮੈਂ ਆਪਣੀ ਪਿੰਡ ਦੀ ਟੀਮ ਨਾਲ ਕਈ ਕ੍ਰਿਕਟ ਟੂਰਨਾਮੈਂਟ 'ਤੇ ਗਿਆ ਹਾਂ ਇਸ ਵਿੱਚ ਸਾਡੀ ਕਈ ਵਾਰ ਫਸਟ ਪੁਜੀਸ਼ਨ ਆਈ ਹੈ ਅਤੇ ਇਨਾਮ ਵਜੋਂ ਸਾਨੂੰ ਕਾਫੀ ਰਾਸ਼ੀ ਅਤੇ ਕਈ ਇਨਾਮ ਮਿਲੇ ਹਨ